ਰੇਲ ਗੱਡੀ ਸਟੀਲ ਦੇ ਪਹੀਆਂ ਦੇ ਨਾਲ ਸਟੀਲ ਦੀ ਪਟਰੀ ਉੱਤੇ ਚੱਲਣ ਵਾਲੀ ਹੁੰਦੀ ਹੈ ਇਸ ਦੇ ਵਿੱਚ ਆਰਾਮਦਾਇਕ ਸੀਟਾਂ ਹੁੰਦੀਆਂ ਹਨ ਸੌਣ ਲਈ ਬਰਥ ਵੀ ਬਣੀਆਂ ਹੁੰਦੀਆਂ ਹਨ ਕੁਝ ਇੰਜਨ ਲੋਕੋਮੋਟਿਵ ਹੁੰਦੇ ਹਨ ਕੁਝ ਬਿਜਲੀ ਨਾਲ ਚੱਲਣ ਵਾਲੇ ਹੁੰਦੇ ਹਨ ਜਿਹੜੀ ਇਲੈਕਟਰੋਨਿਕ ਰੇਲ ਗੱਡੀਆਂ ਚੱਲੀਆਂ ਹਨ ਉਹਨਾਂ ਦਾ ਸ਼ੋਰ ਆਮ ਰੇਲ ਗੱਡੀਆਂ ਨਾਲੋਂ ਬਹੁਤ ਘੱਟ ਹੈ ਮੈਂ ਵੀ ਰੇਲ ਗੱਡੀ ਦੇ ਵਿੱਚ ਜਲੰਧਰ ਸ਼ਹਿਰ ਤੋਂ ਲੈ ਕੇ ਪਟਨਾ ਤੱਕ ਯਾਤਰਾ ਕੀਤੀ ਜਿਸ ਦੇ ਵਿੱਚ ਅਸੀਂ ਇੱਕ ਸੁਪਰ ਫਾਸਟ ਗੱਡੀ ਦੀ ਥਰਡ ਏਸੀ ਦੀਆਂ ਟਿਕਟਾਂ ਬੁੱਕ ਕਰਾਈਆਂ ਸਨ ਜਦੋਂ ਅਸੀਂ ਗੱਡੀ ਦੇ ਵਿੱਚ ਸਫਰ ਕੀਤਾ ਤਾਂ ਗੱਡੀ ਦੇ ਵਿੱਚ ਸਫਾਈ ਨਹੀਂ ਸੀ ਸੀਟਾਂ ਵੀ ਫਟੀਆ ਹੋਈਆਂ ਸਨ ਅਤੇ ਸੋਣ ਦੇ ਲਈ ਚਾਦਰਾਂ ਵੀ ਸਾਫ ਨਹੀਂ ਦਿੱਤੀਆਂ ਗਈਆਂ ਸੀਟਾਂ ਦੇ ਥੱਲੇ ਕੋਕਰੋਚ ਘੁੰਮ ਰਹੇ ਸਨ ਅਸੀਂ ਉਮੀਦ ਕਰਦੇ ਸੀ ਕਿ ਇਹ ਗੱਡੀ ਸਾਫ ਮਿਲੂਗੀ ਜਦੋਂ ਅਸੀਂ ਵਧੀਆ ਗੱਡੀਆਂ ਦੇ ਵਿੱਚ ਅੱਛੀ ਜਗ੍ਹਾ 'ਤੇ ਸਫਰ ਕਰਦੇ ਹਾਂ ਤਾਂ ਇਹ ਸਭ ਕੁਝ ਨਹੀਂ ਹੁੰਦਾ ਜੋ ਕਿ ਸਾਨੂੰ ਇੱਥੇ ਝੇਲਣਾ ਪਿਆ